ਹੈਲੋ ਹੈਲੋ ਹਾਂਜੀ ਸਰ ਫਲਿੱਪਕਾਟ ਤੋਂ ਬੋਲ ਰਹੇ ਹੋ ਅੱਛਾ ਜੀ ਸਰ ਮੈਂ ਨਾ ਤੁਹਾਡੀ ਵੈਬਸਾਈਟ 'ਤੇ ਜਾ ਕੇ ਇੱਕ ਫੋਨ ਔਡਰ ਕੀਤਾ ਸੀ ਮੈਨੂੰ ਕਾਫ਼ੀ ਅਰਜੈਂਟ ਚਾਹੀਦਾ ਸੀ ਵੀਵੋ ਟ ਨਾਈਨਟੀਨ ਟਵੰਟੀ ਲੇਕਿਨ ਪਹਿਲੇ ਤਾਂ ਮੈਨੂੰ ਹਫ਼ਤਾ ਹੋ ਗਿਆ ਕਿ ਔਡਰ ਕੀਤੇ ਨੂੰ ਅਤੇ ਅੱਜ ਤੁਹਾਡਾ ਆਇਆ ਜੇ ਔਡਰ ਪਹਿਲੇ ਤਾਂ ਤੁਸੀਂ ਇੰਨਾ ਕੁ ਡਿਲੇਅ ਕਰਤਾ ਕਿ ਕਦੇ ਬੰਦੇ ਨੂੰ ਅਰਜੈਂਟ ਹੁੰਦਾ ਤਾਂ ਤੱਦੇ ਬੰਦਾ ਔਨਲਾਈਨ ਚੀਜ਼ ਮੰਗਵਾਉਂਦਾ ਦੂਸਰਾ ਜਿਹੜਾ ਤੁਹਾਡਾ ਔਨਲਾਈਨ ਆਇਆ ਹੈ ਵਰਕਰ ਦੇਣ ਵਾਸਤੇ ਉਹਨਾ ਦਾ ਬਿਹੇਵੀਅਰ ਇੰਨਾ ਕੁ ਚੀਪ ਸੀ ਕਿ ਵਾਰ ਵਾਰ ਫੋਨ ਕਰੀ ਚੱਲੇ ਕਿ ਮੈਮ ਮੈਂ ਗਲੀ 'ਚ ਨਹੀਂ ਆਉਣਾ ਤੁਸੀਂ ਬਾਹਰ ਆ ਕੇ ਲੈ ਜਾਓ ਮੈਮ ਮੈਂ ਗਲੀ 'ਚ ਨਹੀਂ ਆਉਣਾ ਤੁਸੀਂ ਬਾਹਰ ਆ ਕੇ ਲੈ ਜਾਓ ਸਰ ਜੇ ਮੈਂ ਐਡਰੈਸ ਮੈਨਸ਼ਨ ਕੀਤਾ ਸੀ ਤਾਂ ਉਹਨਾ ਦੀ ਡਿਊਟੀ ਸੀਗੀ ਘਰ ਆ ਕੇ ਪਹੁੰਚਾਵੇ ਜਿਹੜਾ ਮੈਂ ਘਰ ਜਿਹੜਾ ਮੈਂ ਘਰ ਨਹੀਂ ਆਉਣਾ ਅਤੇ ਗਲੀ ਅਤੇ ਉਹਦੇ 'ਚ ਆਵੇ ਪਰ ਉਹ ਗਲੀ 'ਚ ਨਹੀਂ ਆਇਆ ਮੈਨੂੰ ਬਾਹਰ ਜਾ ਕੇ ਲੈ ਕੇ ਆਉਣਾ ਪਿਆ ਇਹ ਉਹਨਾ ਦੀ ਡਿਲੀਵਰੀ ਅੱਛੀ ਨਹੀਂ ਸੀ ਉਹਨਾ ਦੀ ਥੋੜ੍ਹਾ ਚੰਗੀ ਤਰ੍ਹਾਂ ਜਾਣ ਪਟਕਾਰ ਲਗਾਓ ਉਹਨੂੰ ਉਹਨੂੰ ਇਹੋ ਜਿਹੇ ਸਟਾਫ ਨੂੰ ਨਾ ਰੱਖੋ ਕਿ ਜਿਹੜਾ ਤੁਹਾਡੀ ਜਿਹੜੀ ਤੁਹਾਡੇ ਕਸਟਮਰ ਹੈ ਉਹ ਖ਼ਰਾਬ ਹੋਣ ਇਹੋ ਜਿਹੇ ਸਟਾਫ ਦੀ ਕਲਾਸ ਲਗਾਉਣੀ ਚਾਹੀਦੀ ਹੈ ਦੂਸਰਾ ਜੇ ਅੱਜ ਇੰਨੀ ਦੇਰ ਬਾਅਦ ਪ੍ਰੋਡਕਟ ਆਇਆ ਹੀ ਹੈ ਅਤੇ ਉਹਦਾ ਜਿਹੜੀ ਪੈਕਿੰਗ ਸਿਸਟਮ ਸੀ ਸਾਰੀ ਖੁੱਲ੍ਹੀ ਪਈ ਸੀ ਅੰਦਰੋਂ ਫੋਨ ਟੁੱਟਿਆ ਪਿਆ ਸੀ ਜਿਹੜਾ ਦੇਖ ਕੇ ਮੈਨੂੰ ਕਿ ਬੜਾ ਗੁੱਸਾ ਵੀ ਚੜਿਆ ਅਤੇ ਇੱਕ ਤੁਹਾਡੇ ਮੈਨੂੰ ਫਲਿੱਪਕਾਰਟ ਤੋਂ ਮੈਨੂੰ ਕੋਈ ਉਹ ਨਹੀਂ ਰਿਹਾ ਕਿ ਅੱਗੋਂ ਤੋਂ ਮੈਂ ਤੁਹਾਡੇ ਫਲਿੱਪਕਾਟ ਤੋਂ ਕੋਈ ਔਡਰ ਮੰਗਵਾਵਾਂਗੀ ਇਸ ਕਰਕੇ ਸਰ ਉਹ ਮੈਂ ਹੁਣ ਪਾ ਤਾ ਰਿਫੰਡ 'ਚ ਅਤੇ ਮੇਰੇ ਪੈਸੇ ਰਿਫੰਡ ਕੀਤੇ ਜਾਣ ਅਤੇ ਆਪਣਾ ਔਡਰ ਆ ਕੇ ਮੈਂ ਉਹਨੂੰ ਐਕਸਚੇਂਜ ਮਤਲਬ ਕਿ ਮੈਂ ਉਹਨੂੰ ਰਿਟਰਨ ਕਰਨਾ ਵਾ ਅਤੇ ਮੇਰੇ ਪੈਸੇ ਜਲਦੀ ਤੋਂ ਜਲਦੀ ਰਿਫੰਡ ਕੀਤੇ ਜਾਣ ਤਾਂ ਕਿ ਮੈਂ ਆਪਣਾ ਨਵਾਂ ਹੋਰ ਪ੍ਰੋਟੈਕਟ ਕਿਤੋਂ ਹੋਰ ਮੰਗਾਵਾਵਾਂ ਜਾਂ ਮੈਂ ਆਪ ਜਾ ਕੇ ਮਾਰਕੀਟ ਤੋਂ ਲੈ ਕੇ ਆਵਾਂ ਇਹ ਮੇਰਾ ਪਹਿਲਾ ਐਕਸਪੀਰੀਅੰਸ ਸੀ ਔ ਔਨਲਾਈਨ ਪ੍ਰੋਡਕਟ ਮੰਗਵਾਉਣ ਦਾ ਜਿਹੜੀ ਕਿ ਮੈਂ ਬੜੀ ਮੈਨੂੰ ਨੈਗਟਿਵਿਟੀ ਮਿਲੀ ਆ ਔਰ ਮੈਨੂੰ ਕੋਈ ਵੀ ਜ਼ਿਆਦਾ ਇੰਨੀ ਕੁ ਹੈਪੀਨੈੱਸ ਨਹੀਂ ਹੋਈ ਕਿ ਮੇਰੀ ਚੀਜ਼ ਬੜੀ ਅੱਛੀ ਆਈ ਹੈ ਤੁਸੀਂ ਮੈਨੂੰ ਬੜਾ ਹੀ ਓ ਡਿਸਪੁਆਇੰਟਡ ਕੀਤਾ ਸਰ